ਹਾਂ ਕੀ ਸਾਡੇ ਸਥਾਨ ਵਿੱਚ ਕਈ ਕਈ ਕਲਾਵਾਂ ਅਤੇ ਸ਼ਿਲਪਕਾਰੀਆਂ ਹਨ ਜੋ ਫਿਲਮਾਂ ਫੈਸ਼ਨ ਸ਼ੋਆਂ ਵਿੱਚ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਸਾਡੇ ਦਰਬਾਰ ਸਾਹਿਬ ਦੀ ਜਾਂ ਮਾਡਲ ਮਿਊਜ਼ੀਅਮ ਵਿੱਚ ਲਗਾਇਆ ਜਾਂਦਾ ਹੈ ਇਸ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕੁਝ ਕਲਾਵਾਂ ਵੀ ਹਨ ਜੋ ਕਿ ਫਿਲਮਾਂ ਵਿੱਚ ਵਰਤੀਆਂ ਜਾਂਦੀਆਂ ਹਨ ਜਿਵੇਂ ਸਾਡੇ ਪੁਰਾਣੇ ਕੱਚੇ ਘਰ ਪੁਰਾਣੀਆਂ ਕੰਧਾਂ ਬਣਾਈਆਂ ਗਲੀਆਂ ਤਸਵੀਰਾਂ ਦੀ ਵਰਤੋਂ ਫਿਲਮਾਂ ਵਿੱਚ ਸਾਡੇ ਅਬਿਆਚਾਰ ਨੂੰ ਸੱਭਿਆਚਾਰ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਚੱਲਿਤ ਕੀਤਾ ਜਾਂਦਾ ਹੈ ਫੈਸ਼ਨ ਸ਼ੋਆਂ ਵਿੱਚ ਵੀ ਸਾਡੇ ਸਾਡੇ ਨਾਲ ਕੱਢੀਆਂ ਹੋਈਆਂ ਫੁਲਕਾਰੀਆਂ ਸੂਟ ਸੋਲ ਆਦਿ ਵੀ ਵਰਤੇ ਜਾਂਦੇ ਹਨ ਉਹਨਾਂ ਦੀ ਪ੍ਰਦਰਸ਼ਨੀ ਵੀ ਲਈ ਲਈ ਕੀਤੀ ਜਾਂਦੀ ਹੈ ਇਤਿਹਾਸਿਕ ਇਤਿਹਾਸਬਾਜ਼ੀ ਵਿੱਚ ਕਈ ਸਾਡੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ